ਪੰਜਾਬ ਵਿੱਚ ਜਿਹੜੇ ਰਾਜਨੀਤਿਕ ਸੋਮੇ ਹਨ ਉਹ ਹੁਣ ਸਰਕਾਰਾਂ ਨੂੰ ਸੌਂਪ ਦਿੱਤੇ ਹਨ ਜਿਸ ਕਰਕੇ ਹੁਣ ਉਹ ਸਰਕਾਰਾਂ ਦੇ ਅੰਡਰ ਹੋ ਗਏ ਹਨ ਅਤੇ ਸ ਸਥਾਨਕ ਸਰਕਾਰਾਂ ਜਿਹੜੀਆਂ ਹਨ ਉਹਨਾਂ ਨੂੰ ਜਿਵੇਂ ਗਲੀਆਂ ਅਤੇ ਸੜਕਾਂ ਦਾ ਨਿਰਮਾਣ ਨਹੀਂ ਕ ਕਰ ਰਹੀਆਂ ਸ਼ਾਸਨ ਸਵੈ ਸ਼ਾਸਨ ਅੰਤਰਰਾਸ਼ਟਰੀ ਸੰਬੰਧ ਚਲਾਉਣ ਵਿੱਚ ਉਹਨਾਂ ਦੀ ਮਦਦ ਕਰਦੀਆਂ ਹਨ ਅਤੇ ਸਰਕਾਰਾਂ ਨੂੰ ਕੰਮ ਸੌਂਪਣ ਵਿੱਚ ਯਕੀਨੀ ਬਣਾਉਂਦੀਆਂ ਹਨ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਅਤੇ ਉਹ ਭਾ ਗਲੀ ਗਲੀ ਜਾ ਕੇ ਔਰਤਾਂ ਤੋਂ ਪੁੱਛਦੇ ਹਨ ਕਿ ਉਹਨਾਂ ਨੂੰ ਕੀ ਕੰਮ ਚਾਹੀਦਾ ਹੈ ਵਧੀਆ ਵਿਕੇਂਦਰੀਕਰਨ ਵੀ ਕਰਦੇ ਹਨ ਉਸ ਤਰ੍ਹਾਂ ਦਾ ਸਰੋਤਾਂ ਦਾ ਅਲੱਗ ਅਲੱਗ ਸਰੋਤਾਂ ਦੇ ਨਿਰਮਾਣ ਕਰਦੇ ਜਿਸ ਕਰਕੇ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਉਹ ਪੰਜਾਬ ਵਿੱਚ ਸ਼ਕਤੀ ਦਾ ਨਿਰਮਾਣ ਕਰਦੇ ਹਨ ਜਿਸ ਕਰਕੇ ਲੋਕ ਵਧੀਆ ਤਰੀਕੇ ਨਾਲ ਰਹਿ ਸਕਣ ਅਤੇ ਉਹਨਾਂ ਨੂੰ ਯਕੀਨੀ ਬਣਾਉਣ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਅਸੀਂ ਇਹ ਕੰਮ ਵਧੀਆ ਤਰੀਕੇ ਨਾਲ ਕਰ ਰਹੇ ਹਨ ਤਾਂ ਕਰਕੇ ਸਾਨੂੰ ਵਿਕੇਂਦਰੀਕਰਨ ਦੇ ਸਰੋਤਾਂ ਦੇ ਸਥਾਨਕ ਸਰਕਾਰਾਂ ਨੂੰ ਸੌਂਪਣ ਨੂੰ ਯਕੀਨੀ ਬਣਾਉਂਦੀ ਹੈ ਇਸ ਲਈ ਇਹ ਬਹੁਤ ਵਧੀਆ ਕੰਮ ਕਰਦੀ ਹੈ ਸਰਕਾਰ